ਮੈਂ ਅੰਗਰੇਜ਼ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਧਰਮ ਹੈ ਜੋ ਤੁਸੀਂ ਕਿਹੜੇ ਹੋ ਕੀ ਤੁਹਾਡੇ ਧਰਮ ਨਾਲ ਸੰਬੰਧਿਤ ਕੋਈ ਮਹੱਤਵਪੂਰਨ ਸਹਾਇਤ ਘਟਨਾਵਾਂ ਹਨ ਕਿਸੇ ਵੀ ਧਰਮ ਤਿਉਹਾਰ ਕਿਸੇ ਦੀ ਕਹਾਣੀ ਰੀਤੀ ਰਿਵਾਜ ਦੀ ਸਿਆਸਤ ਇੱਕ ਮਹੱਤਵ ਵ ਸੱਭਿਆਚਾਰ ਨੂੰ ਬਚਾਉਣ ਲਈ ਸੰਘਰਸ਼ ਜਾਂ ਲੜਾਈਆਂ ਦਾ ਸਹਾਇਤਾ ਹਨ ਅਸੀਂ ਸਿੱਖ ਧਰਮ ਨੂੰ ਮੰਨਦੇ ਹਾਂ ਸਾਡੇ ਸਿੱਖ ਧਰਮ ਵਿੱਚ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਬੰਦ ਬੰਦ ਕਟਵਾਏ ਅਤੇ ਚਰਖੜੀਆਂ 'ਤੇ ਚੜ੍ਹੇ ਅਤੇ ਕੇਸਾਂ ਦੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਸਿੱਖਾਂ ਦੇ ਦਸਵੇਂ ਗੁਰੂ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਹਨ ਅਤੇ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਜਾਤ ਪਾਤ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਇੱਕ ਸਮਾਨ ਹੀ ਸਮਝਣਾ ਚਾਹੀਦਾ ਹੈ ਅਤੇ ਗੁਰੂ ਜੀ ਨੇ ਇਹ ਵੀ ਆਖਦੇ ਹਨ ਗੁਰੂ ਗੁਰੂ ਸਾਹਿਬ ਜੀ ਇਹ ਵੀ ਆਖਦੇ ਹਨ ਕਿ ਸਾਰਿਆਂ ਨੂੰ ਇਕੱਠੇ ਹੀ ਲੰਗਰ ਛਕਾਉਣਾ ਚਾਹੀਦਾ ਹੈ ਗੁਰੂ ਜੀ ਆਖਦੇ ਹਨ ਕੋਈ ਵੀ ਕਿਸੇ ਵੀ ਜਾਤ ਪਾਤ ਦਾ ਹੋਵੇ ਪਰ ਆਪਣੇ ਸਿੱਖਾਂ ਨੂੰ ਜਾਤ ਪਾਤ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਸਾਰਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਸਾਰੇ ਇਕੱਠੇ ਰਹਿਣ ਕੋਈ ਵੀ ਕਿਸੇ ਵਿੱਚ ਫਰਕ ਨਾ ਕਰ ਸਕੇ ਔਰ ਸਾਡੇ ਦਸਵੇਂ ਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਲੜਾਈਆਂ ਕੀਤੀਆਂ ਆਪਣੇ ਸਿੱਖ ਲਈ ਆਪਣੀ ਸਿੱਖੀ ਨੂੰ ਬਚਾਉਣ ਲਈ ਜੋ ਕਿ ਆਪਣਾ ਪਰਿਵਾਰ ਆਪਣੇ ਉਤੋਂ ਦੀ ਵਾਰ ਦਿੱਤਾ ਸੀਗਾ ਸਾਡੇ ਦਸਵੇਂ ਗੁਰੂ ਜੀ ਨੇ ਬਹੁਤ ਲੜਾਈਆਂ ਕੀਤੀਆਂ ਔਰ ਸਾਡੇ ਸਿੱਖਾਂ ਉੱਤੇ ਜ਼ੁਲਮਾਂ ਨੇ ਮੁਗਲਾਂ ਨੇ ਬਹੁਤ ਜ਼ੁਲਮ ਸਹਿਣ ਕੀਤਾ ਸੀ ਔਰ ਸਾਡੇ ਦਸਵੇਂ ਗੁਰਾਂ ਗੁਰੂ ਜੀ ਦੇ ਪ ਚਾਰ ਪੁੱਤਰਾਂ ਨੂੰ ਦੋ ਪੁੱਤਾਂ ਨੂੰ ਨੀਹਾਂ ਵਿੱਚ ਚਨਾਅ ਦਿੱਤਾ ਸੀ ਅਤੇ ਦੋ ਪੁੱਤਾਂ ਦੀ ਇੱਕ ਜੰਗ ਦੇ ਵਿੱਚ ਲੜਾਈ ਹੋ ਗਈ ਸੀ ਅਤੇ ਮੌਤ ਹੋ ਗਈ ਸੀ